ਮੈਨੂੰ ਚਿੱਤਰਕਾਰੀ ਦਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਕ ਸੀ ਇਸ ਕਰਕੇ ਮੈਂ ਘਰ ਦੇ ਵਿੱਚ ਹੀ ਪਹਿਲਾਂ ਚਿੱਤਰਕਾਰੀ ਕਰਿਆ ਕਰਦੀ ਸੀਗੀ ਉਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਸਕੂਲ ਵਿੱਚ ਅਡਮਿਸ਼ਨ ਲਈ ਅਤੇ ਕੁਛ ਵੱਡੀਆਂ ਕਲਾਸਾਂ ਵਿੱਚ ਹੋਏ ਤਾਂ ਸਾਨੂੰ ਉੱਥੇ ਵੀ ਚਿੱਤਰਕਾਰੀ ਸਿਖਾਉਣੀ ਜੋ ਸ਼ੁਰੀ ਸ਼ੁਰੂ ਹੋ ਗਈ ਸੀ ਸਾਨੂੰ ਉੱਥੋਂ ਦੇ ਅਧਿਆਪਕ ਚਿੱਤਰਕਾਰੀ ਸਿਖਾਇਆ ਕਰਦੇ ਸੀਗੇ ਜਿਸ ਕਰਕੇ ਸਾਡੀ ਚਿੱਤਰਕਾਰੀ ਵਿੱਚ ਕਾਫੀ ਜੋ ਹੈ ਉਹ ਵਧੀਆ ਨਿਖਾਰ ਆਇਆ ਸੀਗਾ ਅਤੇ ਹੌਲੀ ਹੌਲੀ ਚਿੱਤਰਕਾਰੀ ਵਿੱਚ ਕਾਫੀ ਸੁਧਾਰ ਹੋਣ ਕਰਕੇ ਸਾਰਿਆਂ ਨੂੰ ਹੀ ਜੋ ਮੇਰੀ ਚਿੱਤਰਕਾਰੀ ਸੀ ਉਹ ਬਹੁਤ ਪਸੰਦ ਆਉਣ ਲੱਗ ਗਈ ਸੀਗੀ ਅਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਵੀ ਇੱਕ ਚਿੱਤਰਕਾਰੀ ਦਾ ਸੈਂਟਰ ਹੈ ਜਿਹਨੂੰ ਆਰਟ ਕੈਲਰੀ ਵੀ ਕਿਹਾ ਜਾਂਦਾ ਹੈ ਉੱਥੇ ਕਾਫੀ ਸਾਰੇ ਜੋ ਚਿੱਤਰਕਾਰੀ ਨੇ ਆਪਣੀਆਂ ਚਿੱਤਰਕਾਰੀਆਂ ਉੱਥੇ ਅ ਪੇਸ਼ ਕਰਦੇ ਨੇ ਜੋ ਸਾਰੇ ਹੀ ਲੋਕ ਉੱਥੇ ਦੇਖਣ ਆਉਂਦੇ ਨੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਅਤੇ ਮੈਂ ਆਪਣੀ ਕਲਾਕਾਰੀ ਲਈ ਕਰੀਅਰ ਵਿੱਚ ਇਹ ਸੋਚਿਆ ਹੈ ਕਿ ਮੈਂ ਵੀ ਇੱਕ ਫੇਮਸ ਆਰਟਿਸਟ ਬਣਾਂ ਜਿਸ ਕਰਕੇ ਸਾਰੇ ਹੀ ਲੋਕ ਮੇਰੀ ਚਿੱਤਰਕਾਰੀ ਬਾਰੇ ਜਾਣਨ ਅਤੇ ਬਹੁਤ ਹੀ ਜ਼ਿਆਦਾ ਪਸੰਦ ਕਰਨ ਮੇਰੀ ਚਿੱਤਰਕਾਰੀ ਨੂੰ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਰੋਜ਼ ਹੀ ਮਿਹਨਤ ਕਰਦੀ ਹਾਂ ਅਤੇ ਆਪਣੀ ਚਿੱਤਰਕਾਰੀ ਵਿੱਚ ਨਿਖਾਰ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ ਠੈਂਕ ਯੂ